ਕੀ ਤੁਸੀਂ ਗੋਇਲ ਏਜੰਸੀ ਤੋਂ ਬੋਲ ਰਹੇ ਹੋ ਮੈਂ ਤੁਹਾਡੇ ਤੋਂ ਕੋਵਿਡ ਦੌਰਾਨ ਇੱਕ ਕੈਬ ਬੁੱਕ ਕੀਤੀ ਸੀ ਕਿਉਂਕਿ ਮੈਂ ਆਪਣੇ ਪਰਿਵਾਰ ਨਾਲ ਨਕੋਦਰ ਦੇ ਧਾਰਮਿਕ ਸਥਾਨ 'ਤੇ ਦਰਸ਼ਨ ਲਈ ਜਾਣਾ ਸੀ ਸਾਡੇ ਦਰਸ਼ਨ ਤਾਂ ਵਧੀਆ ਰਹੇ ਪਰ ਜੋ ਤੁਹਾਡੇ ਦੁਆਰਾ ਭੇਜਿਆ ਗਿਆ ਡਰਾਈਵਰ ਸੀ ਉਸਨੂੰ ਸਫ਼ਾਈ ਵੱਲ ਜ਼ਰਾ ਘੱਟ ਧਿਆਨ ਦਿੱਤਾ ਉਸ ਨੇ ਇਸ ਮਹਾਂਮਾਰੀ ਦੇ ਚੱਲਦਿਆ ਹੋਇਆ ਵੀ ਮਾਸਕ ਨਹੀਂ ਸੀ ਪਹਿਨਿਆ ਅਤੇ ਕਾਰ ਦੀ ਸਾਫ਼ ਸਫ਼ਾਈ ਵੀ ਨਹੀਂ ਸੀ ਕੀਤੀ ਮੈਨੂੰ ਤੁਹਾਡੇ ਤੋਂ ਇਸ ਅਣਗਹਿਲੀ ਦੀ ਸ਼ਿਕਾਇਤ ਹੈ ਅਤੇ ਮੈਂ ਤੁਹਾਨੂੰ ਤੁਹਾਡੇ ਡਰਾਈਵਰ ਦੀ ਇਹ ਗੱਲ ਚੰਗੀ ਨਹੀਂ ਲੱਗੀ